ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਮੈਂ ਰਾਣੀ ਬੋਲਦੀ ਪਈ ਆ ਸਰ ਮੈਂ ਤਾਂ ਆ ਗਈ ਸੀ ਸਵੇਰੇ ਸਾਢੇ ਸੱਤ ਜਿਹੜਾ ਹੈਗਾ ਕੋਲ ਦਾ ਟਾਈਮ ਖੋਲੋ ਟਾਈਮ ਵੀ ਹਾਂਜੀ ਉਸ ਟਾਈਮ ਆ ਗਈ ਸੀ ਤੁਸੀਂ ਦੱਸੋ ਸਰ ਜੀ ਹਾਂਜੀ ਹਾਂਜੀ ਦੱਸੋ ਕੀ ਕੰਮ ਸਰ ਜੀ ਸਰ ਮੈਂ ਆ ਕਹਿੰਦਾ ਸਵੇਰੇ ਰੈਸਟਿੰਗ ਕੀਤੀ ਸੀ ਡਿਸਟਿੰਗ ਕਰਕੇ ਸਾਰਿਆਂ ਦੀ ਸਾਰੇ ਕਮਰਿਆਂ ਦੀ ਬੈਂਚਾਂ ਦੀ ਰਿਸਟੀ ਕਰ ਗਈ ਸੀ ਤੇ ਉਸ ਤੋਂ ਬਾਅਦ ਆਕੇ ਪਾਣੀ ਭਰਿਆ ਹਾਂਜੀ ਹੁਣ ਗਿਲਾਸ ਗਰੂਸ ਧੋ ਕੇ ਰੱਖੇ ਨੇ ਹਾਂਜੀ ਸਰ ਹਾਂਜੀ ਸਰ ਜੀਓ ਨਾ ਪੁਤਲਾ ਮੇਰੇ ਨਾਲ ਦੇ ਜਿਹੜੇ ਝਾੜੂ ਮਾਰਨ ਵਾਲੇ ਦੀਦੀ ਨੇ ਉਹ ਝਾੜੂ ਮਾਰਤਾ ਹੁਣ ਉਹਨਾਂ ਨੇ ਤਾਂ ਫਿਰ ਮਿੱਟੀ ਹੋ ਗਈ ਹੋਣੀ ਆ ਮੈਂ ਤਾਂ ਡੇਟਿੰਗ ਕਰਕੇ ਗਈ ਸੀ ਸਰ ਹਾਂਜੀ ਤੇ ਮੈਂ ਦੁਬਾਰਾ ਕਰ ਦਿਨੀ ਆ ਕੋਈ ਸਰ ਉਹ ਨਾ ਕਿ ਜਿਹੜੇ ਮੇਰੇ ਨਾਲ ਦੇ ਪਈਆ ਨੇ ਉਹ ਪਰ ਕਮਰਾ ਵੀ ਚੈੱਕ ਕਰਨਗੇ ਸੀ ਕੋਈ ਕਮਰਾ ਵੀ ਰਹਿ ਨਾ ਗਿਆ ਹੋਵੇ ਬੰਦ ਕਰਦੇ ਨੇ ਨਾ ਜਿਵੇਂ ਸ਼ਾਮ ਨੂੰ ਸਵੇਰੇ ਖੋਲਦੇ ਨੇ ਤੇ ਉਹ ਮਤਲਬ ਵੀ ਵੇਖਣ ਗਏ ਨੇ ਤੇ ਮੈਂ ਅੰਦਰ ਭਾਂਡੇ ਮਾਂਜਰੀ ਦੀ ਸਬਜੀ ਤੇ ਉਹ ਬਾਕੀ ਸਟਾਫ ਪਾਣੀ ਮੰਗੀ ਜਾਂਦਾ ਸੀ ਉਹਨਾਂ ਨੂੰ ਪਾਣੀ ਦੇਣ ਗਈ ਸੀ ਹਾਂਜੀ ਤਾਂ ਨਹੀਂ ਸੁਣੀ ਸਰ ਜੀ ਹਾਂਜੀ ਸਰ ਸਰ ਇੱਥੇ ਆ ਕੇ ਸਵੇਰੇ ਡਸਟਿੰਗ ਕਰ ਲਈ ਪਾਣੀ ਭਰ ਲਿਆ ਸਟਾਫ ਨੂੰ ਪਾਣੀ ਪਿਆ ਤਾ ਸਾਰਿਆਂ ਨੂੰ ਵੀ ਦਿਓ ਉਸ ਤੋਂ ਬਾਅਦ ਜਿਵੇਂ ਕਿਸੇ ਨੇ ਚਾਹ ਦੀ ਕਹਿ ਤਾ ਚਾਹ ਲਿਆਤੀ ਜਾਂ ਕਈ ਵਾਰੀ ਵੀ ਸਾਡੇ ਕੰਟੀਨ ਹੈਗੀ ਤੇ ਉਹ ਆਪਣੇ ਜਿਵੇਂ ਹੈਗਾ ਤੇ ਆਪਣੇ ਪਤਾ ਹੀ ਤੁਹਾਨੂੰ ਕੰਟੀਨ ਤੇ ਜਿਆਦਾ ਠੀਕ ਫਾਈਲਾਂ ਫੜਾ ਤੀਆਂ ਜਾਂ ਕਈ ਵਾਰ ਕੋਈ ਤਿੰਨਸ ਆ ਗਿਆ ਉਹਨੂੰ ਪਾਣੀ ਪਿਆ ਤਾ ਹਾਂਜੀ ਬਾਕੀ ਟੀਚਰ ਦੇਖੋ ਟੀਫਨ ਵਗੈਰਾ ਰੱਖਣੇ ਵੀ ਹੁੰਦੇ ਨੇ ਲਿਆਣੇ ਵੀ ਹੁੰਦੇ ਨੇ ਹਾਂਜੀ ਆਡੂਲ ਸਰ ਜੀ ਹਾਂਜੀ ਬਸ ਸਰ ਜੀ ਕਾਲਜ ਤਾਂ ਹੀਗਾ ਮੈਨੂੰ ਵੀ ਸਵੇਰੇ ਜਿਵੇਂ ਸਾਢੇ ਮਾ ਕੇ ਆਦਾ ਸਾਰੇ ਤਿਆਰੀ ਵੀਰ ਕੋਲੇ ਤੇ ਵੀ ਜਿਹੜਾ ਕੰਮ ਕਰਨ ਵਾਲਾ ਡਸਟਿੰਗ ਕਰ ਲਈ ਪਾਣੀ ਭਰ ਲਿਆ ਸਟਾਫ ਸਟਾਫ ਨੂੰ ਮਤਲਬ ਜਿਵੇਂ ਵੀ ਚਾਹ ਪਾਣੀ ਦੇ ਤੀ ਜਾਂ ਉਹਨਾਂ ਦੇ ਟਿਫਨ ਰੱਖ ਦਿੱਤੇ ਆਹ ਹੀ ਕੰਮ ਕਰਤੀ ਹਾਂਜੀ ਠੀਕ ਹ ਸਰ ਹਾਂਜੀ ਠੀਕ ਏ ਜੀ ਠੀਕ ਏ ਸਰ